ਮੇਰੇ ਖੇਤਰ ਵਿੱਚ ਵੱਧ ਰਹੇ ਸੈਲਾਨੀਆਂ ਦੇ ਦੌਰਿਆਂ ਨੂੰ ਪੂਰਾ ਕਰਨ ਲਈ ਹਰ ਉਹ ਲੋੜੀਂਦੀ ਚੀਜ਼ ਹੈ ਜੋ ਇੱਕ ਸਲੈਨੀ ਨੂੰ ਸੈਲਾਨੀ ਨੂੰ ਜ਼ਰੂਰਤ ਹੁੰਦੀ ਹੈ ਇੱਥੇ ਹੋਟਲਾਂ ਦੀ ਵੀ ਪੂਰੀ ਵਿਵਸਥਾ ਹੈ ਇੱਥੇ ਆਟੋ ਰਿਕਸ਼ਾ ਮਿਨੀ ਬੱਸ ਅਤੇ ਮੈਟਰੋ ਬੱਸ ਦੀ ਸੇਵਾ ਵੀ ਪ੍ਰਦਾਨ ਕੀਤੀ ਗਈ ਹੈ ਜਿਸ ਕਰਕੇ ਸੈਲਾਨੀਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਅਤੇ ਉਹ ਆਪਣਾ ਜਿੱਥੇ ਵੀ ਜਾਣਾ ਚਾਹੁੰਦੇ ਹਨ ਉੱਥੇ ਘੁੰਮਣ ਜਾ ਸਕਦੇ ਹਨ ਇਸ ਤੋਂ ਇਲਾਵਾ ਸੈਲਾਨੀ ਜਦੋਂ ਵੀ ਇੱਥੇ ਆਉਂਦੇ ਹਨ ਇੱਥੇ ਅੰਮ੍ਰਿਤਸਰ ਨੂੰ ਆਪਾਂ ਗੁਰੂ ਦੀ ਨਗਰੀ ਕਹਿੰਦੇ ਹਾਂ ਇੱਥੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਗੁਰਦੁਆਰੇ ਮੰਦਰ ਬਹੁਤ ਸਾਰੀਆਂ ਇੱਦਾਂ ਦੀ ਜਗ੍ਹਾਵਾਂ ਹਨ ਜਿੱਥੇ ਸੈਲਾਨੀ ਆਉਂਦੇ ਰਹਿੰਦੇ ਹਨ ਇਸ ਕਰਕੇ ਉਹਨਾਂ ਜਗ੍ਹਾਵਾਂ ਨੂੰ ਸਾਫ਼ ਸੁਥਰਾ ਰੱਖਣਾ ਅਤੇ ਉੱਥੇ ਸਹੀ ਸਰਵਿਸ ਪ੍ਰਦਾਨ ਕਰਨਾ ਜਿਸ ਕਾਰਨ ਸੈਲਾਨੀ ਦੁਬਾਰਾ ਇੱਥੇ ਆਉਣ ਲਈ ਇਛੁੱਕ ਰਹਿਣ ਆਕਰਸ਼ਿਤ ਹੋਣ ਅਤੇ ਹੋਰ ਸੈਲਾਨੀ ਵੀ ਆਉਣ ਇੱਥੇ ਆਕਰਸ਼ਿਤ ਹੋਣ ਇਸ ਕਰਕੇ ਸਾਨੂੰ ਇਹ ਪ੍ਰਬੰਧ ਸਰਕਾਰ ਦੁਆਰਾ ਕੀਤੇ ਜਾਂਦੇ ਰਹੇ ਹਨ ਅਤੇ ਅੱਗੇ ਵੀ ਕੀਤੇ ਜਾਣਗੇ ਇਸ ਤੋਂ ਇਲਾਵਾ ਜੇ ਸ ਸੈਲਾਨੀਆਂ ਨੂੰ ਜਿੱਥੇ ਵੀ ਘੁੰਮਣਾ ਹੈ ਉਹਨਾਂ ਲਈ ਮੈਪ ਦੀ ਵਿਵਸਥਾ ਵੀ ਕੀਤੀ ਗਈ ਹੈ ਮੈਟਰੋ ਬੱਸ ਸਟੇਸ਼ਨ ਬਣਾਏ ਗਏ ਹਨ ਜਿੱਥੇ ਉਹ ਦੇਖ ਸਕਦੇ ਹਨ ਕਿ ਹੋਰ ਕਿਹੜੇ ਕਿਹੜੇ ਘੁੰਮਣ ਦੀ ਦਰਸ਼ਨੀ ਥਾਵਾਂ ਹਨ ਜਿੱਥੇ ਉਹ ਜਾ ਸਕਦੇ ਹਨ ਅਤੇ ਉਹ ਟਿਕਟ ਲੈ ਕੇ ਮੈਟਰੋ ਬੱਸ ਵਿੱਚ ਬਹਿ ਕੇ ਉੱਥੇ ਜਾ ਸਕਦੇ ਹਨ ਇਸ ਤਰ੍ਹਾਂ ਨਵੇਂ ਸੈਲਾਨੀ ਵੀ ਆਕਰਸ਼ਿਤ ਹੋਣਗੇ ਅਤੇ ਪੁਰਾਣੇ ਸੈਲਾਨੀ ਵੀ ਦੁਬਾਰਾ ਜ਼ਰੂਰ ਆਉਣਗੇ